ਪੰਜਾਬੀ ਆਪਣੀਆਂ ਪਰੰਪਰਾਵਾਂ ਅਤੇ ਰਿਸ਼ਤਿਆਂ ਪ੍ਰਤੀ ਬਹੁਤ ਖ਼ਾਸ ਹਨ ਹਰ ਤਿਉਹਾਰ ਜਾਂ ਸਮਾਰੋਹ ਦੀਆਂ ਪਹਿਲਾਂ ਤੋਂ ਪਰਿਭਾਸ਼ਿਤ ਰਸਮਾਂ ਹੁੰਦੀਆਂ ਹਨ ਜਿਹਨਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ ਜਨਮ ਹੋਵੇ ਜਾਂ ਵਿਆਹ ਵਾਲ ਕੱਟਣ ਜਾਂ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਦੀ ਪਾਲਣਾ ਜ਼ਰੂਰੀ ਹੈ ਜੋ ਉਹਨਾਂ ਦੇ ਅਨੁਸਾਰ ਇੱਕ ਰਿਸ਼ਤੇ ਨੂੰ ਮਜਬੂਤ ਬਣਾਉਂਦੀ ਹੈ ਅਤੇ ਇੱਕ ਸਹੀ ਸਮਾਜਿਕ ਸਦਭਾਵਨਾ ਪ੍ਰਦਰਸ਼ਨ ਕਰਦੀ ਹੈ ਸ਼ੁੱਭ ਮੰਨਿਆ ਜਾਂਦਾ ਹੈ ਉਦਾਹਰਣ ਲਈ ਕਿਸੇ ਮਹੱਤਵਪੂਰਨ ਘਟਨਾ ਤੋਂ ਪਹਿਲਾਂ ਛਿੱਕਣਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂ ਇਹ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਜੇਕਰ ਛਿੱਕ ਮਾਰੀ ਜਾਵੇ ਤਾਂ ਉਸ ਨਾਲ ਕੰਮ ਵਿਗੜ ਜਾਂਦਾ ਹੈ ਅਤੇ ਹਫਤੇ ਦੇ ਕੁਝ ਦਿਨ ਵਾਲ ਧੋਣ ਲਈ ਵਰਜਿਤ ਮੰਨੇ ਜਾਂਦੇ ਹਨ ਨਵੇਂ ਵਿਆਹੇ ਜੋੜਿਆਂ ਦਾ ਤੇਲ ਪਾ ਕੇ ਸਵਾਗਤ ਕੀਤਾ ਜਾਂਦਾ ਹੈ ਸਿੱਖ ਰਹਿਤ ਮਰਿਆਦਾ ਦੇ ਇੱਕ ਨੁਕਤੇ ਵਿੱਚ ਦੱਸਿਆ ਗਿਆ ਹੈ ਕਿ ਦਸ ਗੁਰੂਆਂ ਵਿੱਚ ਇੱਕ ਆਤਮਾ ਜਾਂ ਹਸਤੀ ਮੂਜੌਦ ਸੀ ਆਰਤੀਆਂ ਕੁਝ ਖਾਸ ਮੌਕਿਆਂ ਤੇ ਕੁਝ ਖ਼ਾਸ ਸਥਾਨਾਂ 'ਤੇ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਰਹਿਤ ਮਰਿਆਦਾ ਇਹ ਨਿਰਧਾਰਤ ਨਹੀਂ ਕਰਦੀ ਹੈ ਹਰਿਮੰਦਰ ਸਾਹਿਬ ਦੇ ਫਰਸ਼ ਨੂੰ ਧੋਣ ਲਈ ਕਾਫੀ ਮਾਤਰਾ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਸਿੱਖ ਡਾਈਸ ਪੂਰਾ ਆਪਣੇ ਵਾਲਾਂ ਨਾਲ ਸੰਬੰਧਿਤ ਅਭਿਆਸਾਂ ਨੂੰ ਕਾਇਮ ਰੱਖਣ ਲਈ ਦੇਸ਼ਾਂ ਦੀਆਂ ਵੱਖ ਵੱਖ ਸੰਸਥਾਵਾਂ ਦੇ ਸੁਰੱਖਿਆ ਅਤੇ ਸੁਰੱਖਿਆ ਉਪਾਵਾਂ ਨਾਲ ਸਮਝੌਤਾ ਜਾਂ ਵਿਰੋਧ ਕਰਦੇ ਦੇਖਿਆ ਜਾਂਦਾ ਹੈ ਮੈਂ ਅਸਲ ਵਿੱਚ ਇੱਕ ਅੰਧ ਵਿਸ਼ਵਾਸ਼ੀ ਨਹੀਂ ਹਾਂ ਪਰ ਮੈਂ ਕੁਝ ਅੰਧ ਵਿਸ਼ਵਾਸ਼ਾਂ ਬਾਰੇ ਜਾਣਦੀ ਹਾਂ ਜਿਹਨਾਂ ਦਾ ਕੁਝ ਪੰਜਾਬੀ ਲੋਕ ਪਾਲਣ ਕਰਦੇ ਹਨ ਉਦਾਹਰਨ ਲਈ ਮੁੰਡਿਆਂ ਨੂੰ ਕੁਝ ਖ਼ਾਸ ਦਿਨਾਂ 'ਤੇ ਮਾਸ ਖਾਣ ਦੀ ਇਜਾਜ਼ਤ ਨਹੀਂ ਹੈ ਅਤੇ ਕੁੜੀਆਂ ਨੂੰ ਕੁਝ ਖ਼ਾਸ ਦਿਨਾਂ 'ਤੇ ਆਪਣੇ ਵਾਲ ਧੋਣ ਦੀ ਇਜਾਜ਼ਤ ਨਹੀਂ ਹੈ ਜਾਂ ਇਹ ਮਾੜੀ ਕਿਸਮਤ ਹੈ ਮੈਂ ਦੂਜਿਆਂ ਬਾਰੇ ਸੁਣਿਆ ਹੈ ਜਿੱਥੇ ਤੁਹਾਨੂੰ ਕੈਂਚੀ ਨੂੰ ਸਹੀ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਜਾਂ ਇਹ ਤੁਹਾਡੇ ਲਈ ਮਾੜੀ ਕਿਸਮਤ ਹੈ ਕੁੜੀਆਂ ਨੂੰ ਰਾਤ ਦੇ ਸਮੇਂ ਆਪਣੇ ਵਾਲਾਂ ਨੂੰ ਬੰਨਣਾ ਚਾਹੀਦਾ ਹੈ ਕਿਉਂਕਿ ਜੇਕਰ ਵਾਲ ਹੇਠਾਂ ਡਿੱਗਦੇ ਹਨ ਤਾਂ ਆਤਮਾਵਾਂ ਆਸਾਨੀ ਨਾਲ ਤੁਹਾਡੇ 'ਤੇ ਹਮਲਾ ਕਰ ਸਕਦੀਆਂ ਹਨ ਅਤੇ ਹੋਰ ਬਹੁਤ ਭਿਆਨਕ ਹਨ ਮੈਨੂੰ ਯਾਦ ਹੈ ਜਦੋਂ ਮੈਂ ਕੁਝ ਸਾਲ ਪਹਿਲਾਂ ਦਿਵਾਲੀ ਦੌਰਾਨ ਭਾਰਤ ਸੀ ਤਾਂ ਮੈਨੂੰ ਸਾਰਾ ਦਿਨ ਆਪਣੇ ਵਾਲਾਂ ਨੂੰ ਢੱਕ ਕੇ ਰੱਖਣਾ ਪੈਂਦਾ ਸੀ ਕਿਉਂਕਿ ਮੈਂ ਸਭ ਤੋਂ ਵੱਡੀ ਲੜਕੀ ਸੀ ਅਤੇ ਜੇਕਰ ਇੱਕ ਵਾਲ ਵੀ ਝੜਦਾ ਸੀ ਤਾਂ ਕੋਈ ਕਾਲਾ ਜਾਦੂ ਕਰਕੇ ਸਾਡੇ ਪਰਿਵਾਰ ਦੇ ਵਿਰੁੱਧ ਵਰਤ ਸਕਦਾ ਸੀ ਮੈਨੂੰ ਉਸ ਦਿਨ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਮੇਰੇ ਕੋਲ ਡੂੰਘੇ ਅਰਥਾਂ ਜਾਂ ਮੂਲਾਂ ਬਾਰੇ ਕੋਈ ਸੁਰਾਗ ਨਹੀਂ ਹੈ ਪਰ ਮੈਂ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਗਈ ਸੀ ਰਾਤ ਨੂੰ ਆਪਣੇ ਨਹੁੰ ਨਾ ਕੱਟੋ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਛਿੱਕ ਨਾ ਮਾਰੋ ਜਾਹਰ ਤੌਰ 'ਤੇ ਛਿੱਕਾਂ ਦੀ ਇੱਕ ਵੀ ਗਿਣਤੀ ਮਾੜੇ ਸ਼ਗਨ ਦਾ ਮੁਕਾਬਲਾ ਕਰਦੀ ਹੈ ਘਰ ਛੱਡਣ ਤੋਂ ਪਹਿਲਾਂ ਕਿਸੇ ਵਿਅਕਤੀ ਦਾ ਨਾਮ ਨਾ ਪੁਕਾਰੋ ਬਿਸਤਰੇ 'ਤੇ ਝਾੜੂ ਨਾ ਛੱਡੋ ਰਾਤ ਨੂੰ ਪੌੜੀਆਂ 'ਤੇ ਨਾ ਬੈਠੋ ਜੇਕਰ ਕੁੱਤੇ ਰਾਤ ਨੂੰ ਬੇਤਰਤੀਬੇ ਭੌਂਕਦੇ ਹਨ ਤਾਂ ਉਹਨਾਂ ਤੋਂ ਦੂਰ ਰਹੋ ਆਪਣੇ ਜੁੱਤੇ ਨੂੰ ਉਲਟਾ ਨਾ ਛੱਡੋ ਕਾਲੀ ਬਿੱਲੀ ਨਾਲ ਰਸਤਾ ਨਾ ਪਾਰ ਕਰੋ ਜੇ ਤੁਹਾਡਾ ਹੱਥ ਖਾਰਸ਼ ਕਰਦਾ ਹੈ ਤਾਂ ਤੁਸੀਂ ਪੈਸੇ ਲੱਭਣ ਜਾਂ ਚੰਗੀ ਕਿਸਮਤ ਪ੍ਰਾਪਤ ਕਰਨ ਜਾ ਰਹੇ ਹੋ ਜੇ ਤੁਹਾਡੀ ਖੱਬੀ ਅੱਖਰ ਮਰੋੜਦੀ ਹੈ ਤਾਂ ਤੁਹਾਡੀ ਬਦਕਿਸਮਤੀ ਤੁਹਾਡੇ ਰਸਤੇ ਆ ਰਹੀ ਹੈ ਜਾਂ ਸੱਜੀ ਅੱਖ ਇਹ ਭੁੱਲ ਜਾਓ ਇਹਨਾਂ ਵਿੱਚੋਂ ਇੱਕ ਅਰਬਾਂ ਵਾਂਗ ਵਹਿਮਾਂ ਭਰਮਾਂ ਹਨ ਇਸ ਲਈ ਮੇਰਾ ਅਨੁਮਾਨ ਹੈ ਕਿ ਜੇ ਤੁਸੀਂ ਮੰਨਦੇ ਹੋ ਕਿ ਇਹ ਬੁਰੀ ਕਿਸਮਤ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਤਾਂ ਬਿਲਕੁਲ ਕੁਝ ਨਾ ਕਰੋ